ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਮੈਂ ਨਾ ਤੁਹਾਡੇ ਤੋਂ ਇੱਕ ਛੋਟੀ ਜਿਹੀ ਸਲਾਹ ਲੈਣਾ ਚਾਹੁੰਦੀ ਹਾਂ ਮੇਰੀ ਬੇਟੀ ਨੇ ਨਾ ਦਸਵੀਂ ਦੇ ਪੇਪਰ ਦਿੱਤੇ ਆ ਅਤੇ ਪਲੱਸ ਵਨ 'ਚ ਮੈਂ ਉਹਦੀ ਐਡਮਿਸ਼ਨ ਕਰਵਾਉਣੀ ਆ ਅਤੇ ਆਪਣੇ ਏਰੀਏ ਦੇ ਵਿੱਚ ਚੰਗਾ ਜਾ ਸਕੂਲ ਮੈਨੂੰ ਜਰਾ ਦੱਸੋ ਕੋਈ ਕਿਹੜੇ ਕਿਹੜੇ ਸਕੂਲ ਚੰਗੇ ਆ ਅਤੇ ਆਪਾਂ ਕਿੱਥੇ ਬੱਚੇ ਨੂੰ ਪਾ ਸਕਦੇ ਹਾਂ ਚੰਗੇ ਭਵਿੱਖ ਲਈ ਅੱਛਾ ਸਰ ਹਾਂਜੀ ਸਰ ਮੈਂ ਵੀ ਸੁਣਿਆ ਇਸ ਬਾਰੇ ਕਿ ਬੜਾ ਵਧੀਆ ਸਕੂਲ ਆ ਸਟਾਫ ਬੜਾ ਵਧੀਆ ਆ ਅਤੇ ਟੀਚਰ ਬੜੇ ਕੋਆਪਰੇਟਿਵ ਹੈਗੇ ਇੱਥੋਂ ਦੇ ਠੀਕ ਹੈ ਸਰ ਅੱਛਾ ਅੱਛਾ ਇਹਦਾ ਮਤਲਬ ਆਪਾਂ ਅੱਛਾ ਅੱਛਾ ਸਰ ਫਿਰ ਇਹਦਾ ਮਤਲਬ ਆਪਾਂ ਬੱਚੇ ਨੂੰ ਉੱਥੇ ਭੇਜ ਸਕਦੇ ਹਾਂ ਮਤਲਬ ਕਿ ਕੋਈ ਸਾਨੂੰ ਸਾਨੂੰ ਕੋਈ ਦਿੱਕਤ ਨਹੀਂ ਆਏਗੀ ਫਿਰ ਹੈ ਨਾ

ਅੱਛਾ ਇਹਦਾ ਮਤਲਬ ਤੁਸੀਂ ਆਪਣੇ ਬੱਚੇ ਨੂੰ ਉੱਥੇ ਹੀ ਪਾ ਰਹੇ ਹੋ ਹਾਂ ਚਲੋ ਠੀਕ ਹੈ ਸਰ ਫਿਰ ਆਪਾਂ ਦੇਖਦੇ ਹਾਂ ਮੈਂ ਵੀ ਆਪਣੇ ਬੇਟੇ ਦੀ ਅਤੇ ਉੱਥੇ ਐਡਮਿਸ਼ਨ ਕਰਵਾਉਂਦੀ ਹਾਂ ਸਰ ਸਲਾਹ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ